ਮੈਨੂੰ ਟੀ ਵੀ ਵੇਖਣਾ ਬਹੁਤ ਪਸੰਦ ਹੈ ਜਿਹਦੇ ਵਿੱਚ ਕਿ ਮੈਂ ਟੀ ਵੀ ਫਿਲਮ ਫਿਲਮ ਵੀ ਦੇਖ ਲੈਂਦੀ ਹਾਂ ਟੀ ਵੀ ਸ਼ੋ ਵੀ ਵੇਖਦੀ ਹਾਂ ਅਤੇ ਖਬਰਾਂ ਵੀ ਮੈਨੂੰ ਵੇ ਸੁਣਨਾ ਬਹੁਤ ਪਸੰਦ ਹੈ ਜਿਸ ਦੇ ਬਾਰੇ ਦੁਨੀਆਂ 'ਤੇ ਹੋਣ ਵਾਲੀਆਂ ਗਤੀਵਿਧੀਆਂ ਦਾ ਪਤਾ ਚੱਲਦਾ ਹੈ ਕਿ ਦੁਨੀਆਂ 'ਤੇ ਕੀ ਚੱਲ ਰਿਹਾ ਹੈ ਮੈਂ ਸ਼ਾਮ ਦੇ ਟਾਇਮ ਸਾਢੇ ਸੱਤ ਵਜੇ ਇੱਕ ਸ਼ੋਅ ਆਉਂਦਾ ਕਿ ਜੋ ਕਿ ਮੈਂ ਦਿਲਾਂ ਦੇ ਰਿਸ਼ਤੇ ਜੋ ਕਿ ਮੈਂ ਰੋਜ਼ ਦੇਖਦੀ ਹਾਂ ਜੀ ਪੰਜਾਬੀ ਦੇ ਚੈਨਲ 'ਤੇ ਸਾਢੇ ਸੱਤ ਵਜੇ ਜੋ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਦਿਲਾਂ ਦੇ ਰਿਸ਼ਤੇ ਖੂਨ ਦੇ ਰਿਸ਼ਤੇ ਤੋਂ ਵੀ ਗੂੜੇ ਹੁੰਦੇ ਨੇ ਉਸ ਦੇ ਵਿੱਚ ਦੋਨੋਂ ਦੋਸਤ ਹੁੰਦੇ ਨੇ ਤਿੰਨੋ ਦੋਸਤ ਹੁੰਦੇ ਨੇ ਦੋਵਾਂ ਦਾ ਆਪਸ ਵਿੱਚ ਵਿਆਹ ਹੋ ਜਾਂਦਾ ਜਿਹੜਾ ਇੱਕ ਦੋਸਤ ਹੁੰਦਾ ਏ ਉਹਦੇ ਜਨਾ ਉਹ ਪ੍ਰੈਗਨੈਂਟ ਉਹਦੀ ਲੇਡ ਉਹਦੀ ਜਨਾਨੀ ਪ੍ਰੈਗਨੈਂਟ ਹੁੰਦੀ ਹੈ ਅਤੇ ਉਹਦੇ ਵਿੱਚ ਉਹ ਕਹਿੰਦੀ ਏ ਕਿ ਜੇ ਮੇਰੇ ਘਰ ਧੀ ਹੋਈ ਮੈਂ ਧੀ ਨੂੰ ਵੀ ਮਾਰ ਲਵਾਂਗੀ ਆਪ ਵੀ ਮਰ ਜਾਵਾਂਗੀ ਦੂਸਰਾ ਦੋਸਤ ਉਹ ਗੱਲ ਸੁਣ ਲੈਂਦਾ ਹੈ ਅਤੇ ਉਹਦੇ ਘਰ ਧੀ ਪੈਦਾ ਹੁੰਦੀ ਹੈ ਉਹ ਉਹਦੇ ਆਪਣੇ ਉਹਦੇ ਦੂਸਰੇ ਦੋਸਤ ਦੇ ਪੁੱਤ ਪੈਦਾ ਹੁੰਦਾ ਏ ਉਹ ਆਪਣੀ ਧੀ ਉਤ ਪੁੱਤ ਉਹਨੂੰ ਦੇ ਦਿੰਦੇ ਅਤੇ ਉਹਦੀ ਜਗ੍ਹਾ ਧੀ ਨੂੰ ਚੁੱਕ ਲੈਂਦੇ ਨੇ ਅਤੇ ਵਧੀਆ ਤਰੀਕੇ ਨਾਲ ਉਹਨਾਂ ਦੀ ਪਰਵਰਿਸ਼ ਕਰਦੇ ਨੇ ਇਸ ਲਈ ਤਰ੍ਹਾਂ ਹੀ ਦੱਸਿਆ ਗਿਆ ਇਸ ਨਾਟਕ ਵਿੱਚ ਇਹ ਦੱਸਿਆ ਗਿਆ ਹੈ ਕਿ ਦਿਲਾਂ ਦੇ ਰਿਸ਼ਤੇ ਖੂਨ ਦੇ ਰਿਸ਼ਤੇ ਤੋਂ ਵੀ ਗੂੜੇ ਹੁੰਦੇ ਨੇ ਇਸ ਤੋਂ ਇਲਾਵਾ ਮੈਂ ਟੀ ਵੀ ਵਿੱਚ ਫਿਲਮ ਵੀ ਵੇਖ ਫਿਲਮਾਂ ਵੀ ਵੇਖ ਲੈਂਦੀ ਹਾਂ ਅਤੇ ਹੋਰ ਦੋ ਕੁ ਸ਼ੋਅ ਹੋਰ ਵੀ ਵੇਖਦੀ ਹਾਂ ਇ ਇ ਜੋ ਕਿ ਮੈਨੂੰ ਬਹੁਤ ਪਸੰਦ ਹਨ ਸਾਨੂੰ ਟੀ ਵੀ ਟੀ ਵੀ ਨਾਲ ਸਾਡਾ ਟਾਈਮਪਾਸ ਹੋ ਜਾਂਦਾ ਹੈ ਅਤੇ ਮੈਂ ਥੋੜ੍ਹਾ ਬਹੁਤ ਇਹਦੇ ਨਾਲ ਆਪਣਾ ਮਨ ਵੀ ਪਰਚਾਇਆ ਜਾਂਦਾ ਹੈ ਮੈਨੂੰ ਟੀ ਵੀ ਨਾਲ ਬਹੁਤ ਲਗਾਵ ਹੈ ਜੋ ਕਿ ਮੈਨੂੰ ਆਪਣੇ ਵਿਹਲੇ ਟਾਇਮ ਵਿੱਚ ਵੀ ਮੈਂ ਟੀ ਵੀ ਵੇਖਣਾ ਬਹੁਤ ਪਸੰਦ ਕਰਦੀ ਹਾਂ ਸਾਨੂੰ ਇਹਨਾਂ ਚੀਜ਼ ਸਾਨੂੰ ਅੱਜ ਦੇ ਸਮੇਂ ਵਿੱਚ ਕਿਸੇ ਕੋਲ ਟਾਈਮ ਹੀ ਨਹੀਂ ਕਿ ਕੋਈ ਕਿਸੇ ਨਾਲ ਬਹਿ ਕੇ ਕੋਈ ਗੱਲਬਾਤ ਕਰ ਸਕੇ ਇਸ ਲਈ ਸ ਸਾਨੂੰ ਆਪਣੇ ਆਪਣੇ ਅਤੇ ਆਪਣੇ ਦਿਲ ਦੇ ਜਜ਼ਬਾਤਾਂ ਲਈ ਕਿਸੇ ਨਾਲ ਗੱਲਬਾਤ ਕਰਕੇ ਕੋਈ ਗੱਲ ਕਰਨ ਦੀ ਲੋੜ ਨਹੀਂ ਹੈ ਕਿ ਅਸੀਂ ਟੀ ਵੀ ਵੇਖ ਕੇ ਆਪਣਾ ਟਾਈਮਪਾਸ ਵਧੀਆ ਮਨੋਰੰਜਨ ਕਰ ਸਕਦੇ